ਇੱਕ ਫਰਵਰੀ ਦੋ ਹਜ਼ਾਰ ਚੌਵੀ ਤੇਈ ਅਗਸਤ ਦੋ ਹਜ਼ਾਰ ਦੋ ਦੋ ਮਾਰਚ ਦੋ ਹਜ਼ਾਰ ਚਾਰ ਛੇ ਅਗਸਤ ਦੋ ਹਜ਼ਾਰ ਇੱਕ ਪੰਦਰਾਂ ਦਸੰਬਰ ਉੱਨੀ ਸੌ ਚੁਰਾਨਵੇਂ